ਸਤਿ ਸ਼੍ਰੀ ਅਕਾਲ ਜੀ ਤੁਸੀਂ ਭੈਣਾਂ ਦੇ ਢਾਬੇ ਤੋਂ ਬੋਲਦੇ ਹੋ ਮੇਰਾ ਨਾਮ ਜਸਨੀਤ ਕੌਰ ਅਤੇ ਮੈਂ ਪਿੰਡ ਪਲਹੇੜੀ ਤੋਂ ਹਾਂ ਅਤੇ ਇੱਕ ਘੰਟੇ ਪਹਿਲਾਂ ਮੈਂ ਤੁਹਾਨੂੰ ਔਡਰ ਦਿੱਤਾ ਸੀ ਦੋ ਸ਼ਾਹੀ ਪਨੀਰ ਦੋ ਕੜਾਹੀ ਪਨੀਰ ਦੋ ਦਾਲ਼ ਮੱਖਣੀ ਚਾਵਲ ਦੋ ਰਾਇਤੇ ਪੰਦਰ੍ਹਾਂ ਰੋਟੀਆਂ ਅਤੇ ਦੋ ਲੱਛੇ ਪਰੌਂਠੇ ਮੈਂ ਇਸ ਔਡਰ ਵਿੱਚ ਕੁਝ ਬਦਲਾਵ ਕਰਨਾ ਚਾਹੁੰਦੀ ਹਾਂ ਅਤੇ ਕੁਝ ਹੋਰ ਚੀਜ਼ਾਂ ਐਡ ਕਰਨਾ ਚਾਹੁੰਦੀ ਹਾਂ ਜਿਹਦੇ 'ਚ ਮਿਕਸ ਵੈੱਜ ਪਨੀਰ ਦੀ ਭੁਰਜੀ ਵੀਹ ਗੁਲਾਬ ਜਾਮੁਨ ਇੱਕ ਆਈਸ ਕ੍ਰੀਮ ਅਤੇ ਦਸ ਰੋਟੀਆਂ ਹੋਰ ਐਡ ਕਰਨਾ ਚਾਹੁੰਦੀ ਹਾਂ ਮੈਂ ਤੁਹਾਡੀ ਸਾਰੀ ਬਣਦੀ ਪੇਮੈਂਟ ਔਨਲਾਈਨ ਜਾਂ ਔਫਲਾਈਨ ਪੇ ਕਰ ਦਾਂਗੀ ਮੇਰਾ ਖਾਣਾ ਜਲਦੀ ਤੋਂ ਜਲਦੀ ਪਹੁੰਚਾਇਆ ਜਾਵੇ ਅਤੇ ਜੇਕਰ ਮੈਨੂੰ ਤੁਹਾਡਾ ਖਾਣਾ ਵਧੀਆ ਲੱਗਿਆ ਤਾਂ ਮੈਂ ਤੁਹਾਨੂੰ ਟਿੱਪ ਵੀ ਦੇਵਾਂਗੀ ਤੁਹਾਡਾ ਧੰਨਵਾਦ